ਬਾਈ ਸਤੰਬਰ ਉੱਨੀ ਸੌ ਛਿਆਨਵੇਂ ਇਕੱਤੀ ਮਈ ਉੱਨੀ ਸੌ ਅਠਾਨਵੇਂ ਦਸ ਅਗਸਤ ਦੋ ਹਜ਼ਾਰ ਸਤਾਰ੍ਹਾਂ ਬਾਰ੍ਹਾਂ ਅਕਤੂਬਰ ਦੋ ਹਜ਼ਾਰ ਸੋਲ੍ਹਾਂ ਚੌਦ੍ਹਾਂ ਫਰਵਰੀ ਦੋ ਹਜ਼ਾਰ ਚੋਦ੍ਹਾਂ